ਹੈਲੋ ਨਮਸਤੇ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ

ਜਿਸ ਕਰਕੇ ਕਹਿੰਦੇ ਆ ਕਿ ਸੰਡੇ ਨੂੰ ਭੀੜ ਜਿਸ ਸੰਡੇ ਨੂੰ ਸੇਲ ਲੱਗਦੀ ਹੈ ਨਾ ਗਾਂਧੀ ਚੌਂਕ ਉਹਦੇ ਵਿੱਚ ਤਾਂ ਇੰਨਾ ਟਰੈਫ਼ਿਕ ਜਾਮ ਹੋ ਜਾਂਦਾ ਏ ਨਾ ਕਿ ਗਾਂਧੀ ਚੌਂਕ 'ਚੋਂ ਨਿਕਲਣਾ ਵੀ ਮੁਸ਼ਕਲ ਹੈ ਗੱਡੀ ਉਹ ਅੰਦਰ ਜਾਣ ਨਹੀਂ ਦਿੰਦੇ ਪੈਦਲ ਲੋਕਾਂ ਦਾ ਇੰਨਾ ਰੱਸ਼ ਹੈ ਨਾ ਅਤੇ ਬੱਚੇ ਤਾਂ ਸਕੂਟੀਆਂ ਇੱਦਾਂ ਚਲਾਉਂਦੇ ਹੈ ਅਤੇ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰਹਿੰਦਾ

ਅੱਛਾ ਛੋਟੇ ਛੋਟੇ ਬੱਚਿਆਂ ਨੂੰ ਲੋਕ ਸਕੂਟੀਆਂ ਦੇ ਕੇ ਬਜ਼ਾਰਾਂ ਨੂੰ ਤੋਰ ਦਿੰਦੇ ਉਹਨਾਂ ਨੂੰ ਚਲਾਉਣ ਦਾ ਨਹੀਂ ਪਤਾ ਕਿਸੇ ਕੋਲ ਲਾਸੰਸ ਨਹੀਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਫਿਰ ਅੰਨ੍ਹੇਵਾਹ ਲੋਕੀ ਸਕੂਟੀਆਂ ਚਲਾਉਂਦੇ ਮੋਟਰਸਾਈਕਲ ਚਲਾਉਂਦੇ ਆ ਇਹ ਨਹੀਂ ਵੇਖਦੇ ਕੋਈ ਸਿਆਣਾ ਹੈ ਕੋਈ ਬਜ਼ੁਰਗ ਹੈ ਅਤੇ ਬਾਰ੍ਹਾਂ ਵਜੇ ਕਦੇ ਕਿਸੇ 'ਚ ਮਾਰ ਦਿੰਦੇ ਕਦੀ ਕਿਸੇ 'ਚ ਮਾਰਦੇ ਕੋਈ ਨਾ ਕੋਈ ਨੁਕਸਾਨ ਕਰਾਈ ਦਾ ਰੱਖਦਾ ਕਈ ਪਰ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਨਾ ਅੱਜ ਕੱਲ੍ਹ ਇੰਨੀ ਟਰੈਫ਼ਿਕ ਵੱਧ ਰਹੀ ਘਰ ਘਰ ਤਾਂ ਸਾਧਨ ਹੋ ਗਏ ਦੇ ਟਰੈਫ਼ਿਕ ਤਾਂ ਵਧਣੀ ਵਧਣੀ ਹਾਂਜੀ ਉਹੀ ਤਾਂ ਮੈਂ ਕਹਿੰਦੀ ਪਈ ਨਾ ਸੰਡੇ ਦੀ ਜਿਹੜੀ ਭੀੜ ਸੰਡੇ ਵਾਲੀ ਜਿਹੜੀ ਸੈਲ ਹੈ ਨਾ ਉਹਨੇ ਤੇ ਵੈਸੇ ਬੜਾ ਟਰੈਫ਼ਿਕ ਜਾਮ ਕੀਤੇ ਦੈ ਪਠਾਨਕੋਟ 'ਚ ਹਾ ਇਹਦਾ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਇਹਨਾਂ ਨੂੰ ਇੱਦਾਂ ਤਾਂ ਬਹੁਤ ਨੁਕਸਾਨ ਹੋ ਜਾਣਾ ਕਰਨਾ ਕਿਉਂਕਿ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਕੰਮ ਤੇ ਪਿਆ ਈ ਰਹਿੰਦਾ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਕਿ ਫਿਰ ਬੱਚਿਆਂ ਨੂੰ ਸਕੂਟੀਆਂ ਵੀ ਨਹੀਂ ਦੇਣੀਆਂ ਚਾਹੀਦੀਆਂ ਛੋਟੇ ਛੋਟੇ ਬੱਚਿਆਂ ਨੂੰ ਪੰਦਰਾਂ ਪੰਦਰਾਂ ਸਾਲ ਦੇ ਬੱਚੇ ਜਿਹਨਾਂ ਨੂੰ ਸਕੂਟੀਆਂ ਦੇ ਦਿੰਦੇ ਹੈ ਪਰ ਉਹ ਵੀ ਨੁਕਸਾਨ ਦਾ ਘਰ ਹੀ ਹੈ ਆਪਣੇ ਲੱਗ ਜਾਏ ਅਗਲੇ ਦੇ ਲੱਗ ਜਾਏ ਫਿਰ ਮੁਸ਼ਕਲ ਕਿੰਨੀ ਹੈ ਓਕੇ ਜੀ